ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਅਤੇ ਸਾਨੂੰ ਪੰਜਾਬੀ ਹੋਣ 'ਤੇ ਪੰਜਾਬੀ ਬੋਲਣ 'ਤੇ ਬਹੁਤ ਮਾਣ ਹੈ ਅਤੇ ਅਸੀਂ ਬਹੁਤ ਗਰਬ ਮਹਿਸੂਸ ਕਰਦੇ ਹਾਂ ਅਤੇ ਗੱਲ ਕਰੀ ਜਾਈਏ ਪੰਜਾਬੀ ਦੀ ਭਾਸ਼ਾ ਨੂੰ ਹੋਰ ਭਾਸ਼ਾਵਾਂ ਨਾਲ ਕਿਵੇਂ ਪ੍ਰਭਾਵ ਪਿਆ ਇਹ ਅੰਗਰੇਜ਼ੀ ਭਾਸ਼ਾ ਨਾਲ ਹੁਣ ਮਤਲਬ ਕਿ ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਜਿੱਦਾਂ ਕਿ ਗੱਲ ਕਰੀਏ ਸਕੂਲਾਂ ਕਾਲਜਾਂ ਵਿੱਚ ਸਾਰੇ ਕਿਤੇ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਜ਼ੋਰ ਦੇ ਰਹੇ ਨੇ ਹਿੰ ਪੰਜਾਬੀ ਭਾਸ਼ਾ ਨੂੰ ਇੰਨਾ ਜ਼ੋਰ ਨਹੀਂ ਦੇ ਰਹੇ ਉਹ ਕਿਉਂਕਿ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਉਹਨਾਂ ਨੇ ਤਾਂ ਪੰਜਾਬੀ ਬੋਲਣ 'ਤੇ ਹੀ ਵ ਮਤਲਬ ਕਿ ਬੱਚਿਆਂ ਨੂੰ ਜੁਰਮਾਨਾ ਲਾਇਆ ਹੋਇਆ ਹੈ ਅਤੇ ਇੱਦਾਂ ਹੀ ਗੱਲ ਕੀਤੀ ਜਾਵੇ ਸ ਕੋਲਜਾਂ ਦੀ ਤਾਂ ਕੋਲਜਾਂ ਵਿੱਚ ਵੀ ਉਹ ਮਤਲਬ ਕਿ ਜਿੱਦਾਂ ਪ੍ਰਾਈਵੇਟ ਕੋਲਜ ਨੇ ਜਿਹੜੇ ਉਹਨਾਂ ਨੇ ਜ਼ਿਆਦਾਤਰ ਆਪਣਾ ਸਾਰਾ ਸਿਲੇਬਸ ਹੀ ਇੰਗਲਿਸ਼ ਉਹਦੇ ਵਿੱਚ ਕੀਤਾ ਹੋਇਆ ਅਤੇ ਅ ਗੱਲ ਕਰੀਏ ਅ ਪ੍ਰਾ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਵਿੱਚ ਵੀ ਟੀਚਰ ਨੇ ਜਿਹੜੇ ਜੋ ਉਹ ਇੰਨੇ ਮਤਲਬ ਕਿ ਉਹ ਪੰਜਾਬੀ ਭਾਸ਼ਾ ਨੂੰ ਉਹ ਪ੍ਰਮੋਟ ਨਹੀਂ ਕਰਦੇ ਵੀ ਆਪਣੇ ਜਿਹੜੇ ਬੱਚੇ ਨੇ ਉਹ ਅੱਗੇ ਜਾ ਕੇ ਵੀ ਪੰਜਾਬੀ ਭਾਸ਼ਾ ਬੋਲੇ ਅਤੇ ਇੱਦਾਂ ਹੀ ਲੋਕ ਨੇ ਜਿਹੜੇ ਪੰਜਾਬ ਦੇ ਉਹ ਜ਼ਿਆਦਾਤਰ ਬਾਹਰ ਜਾ ਰਹੇ ਨੇ ਉਹਦੇ ਕਰਕੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਉਹ ਰੁਝਾਨ ਵੱਧ ਰਿਹਾ ਅਤੇ ਜਿਹੜੀ ਪੰਜਾਬੀ ਭਾਸ਼ਾ ਸਾਡੀ ਉਹ ਪਿੱਛੇ ਜਾ ਰਹੀ ਹੈ ਵੈਸੇ ਸਰਕਾਰਾਂ ਨੂੰ ਕਰਨਾ ਚਾਹੀਦਾ ਵੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਉਹਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਜੋ ਜਿਹੜੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਇਹ ਇੱਕ ਦਬੀ ਹੋਈ ਭਾਸ਼ਾ ਨਾ ਰਹਿ ਜਾਵੇ ਅਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗ ਰਿਹਾ ਵੀ ਸਾਡੀ ਪੰਜਾਬੀ ਭਾਸ਼ਾ ਖਤਰੇ ਦੇ ਨਿਸ਼ਾਨ ਹੇਠ ਜਾ ਰਹੀ ਹੈ